ਸਰਕਾਰੀ ਨੌਕਰੀ ਅਤੇ ਆਪਣਾ ਕਾਰੋਬਾਰ ਦੋਨੋਂ ਹੀ ਅਲੱਗ ਅਲੱਗ ਤਰ੍ਹਾਂ ਦੇ ਕੰਮ ਹਨ ਜਿਵੇਂ ਕਿ ਕਾ ਸਰਕਾਰੀ ਨੌਕਰੀ ਅਤੇ ਆਪਣੇ ਕਾਰੋਬਾਰ ਵਿੱਚ ਬਹੁਤ ਹੀ ਅੰਤਰ ਹੈ ਅਤੇ ਮੈਂ ਅਗਰ ਇਹਨਾਂ ਦੋਨਾਂ ਵਿੱਚੋਂ ਅਗਰ ਇੱਕ ਨੂੰ ਚੁਣਨਾ ਹੋਵੇ ਤਾਂ ਮੈਂ ਆਪਣੇ ਕੰ ਕਾਰੋਬਾਰ ਕਰਨਾ ਚਾਹਾਂਗਾ ਕਿਉਂਕਿ ਸਰਕਾਰੀ ਨੌਕਰੀ ਹੋਵੇ ਜਾਂ ਪ੍ਰਾਈਵੇਟ ਨੌਕਰੀ ਦੇ ਵਿੱਚ ਬੰਦਾ ਆਪਣੀ ਇੱਕ ਇੱਕ ਲਿਮਿਟ ਦੇ ਨਾਲ ਹੀ ਕਮਾਈ ਕਰ ਸਕਦਾ ਹੈ ਕੋਈ ਵੀ ਉੱਪਰੋਂ ਬਾਅਦ ਇੱਕ ਅੱਛੇ ਤਰੀਕੇ ਨਾਲ ਨਹੀਂ ਕਮਾ ਸਕਦਾ ਪਰ ਆਪਣੇ ਕਾਰੋਬਾਰ ਦੇ ਵਿੱਚ ਅਸੀਂ ਅਲੱਗ ਅਲੱਗ ਤਰੀਕੇ ਦੇ ਨਾਲ ਆਪਣੇ ਆਪ ਨੂੰ ਸਹੂਲਤ ਬੰਦ ਬਣਾ ਸਕਦੇ ਹਾਂ ਜਿਵੇਂ ਕਿ ਕਮਾਈ ਦੇ ਵਿੱਚ ਸਾਧਨ ਕਰਕੇ ਅਸੀਂ ਹੋਰ ਕਮਾਈ ਕਰ ਸਕਦੇ ਹਾਂ ਅਤੇ ਅਲੱਗ ਅਲੱਗ ਤਰੀਕੇ ਦੇ ਕਾਰੋਬਾਰ ਨੂੰ ਹੋਰ ਵਧਾ ਕੇ ਆਪਣੇ ਕੰਮ ਨੂੰ ਚਲਾ ਕੇ ਅਤੇ ਆਪਣੀ ਕਮਾਈ ਹੋਰ ਨੂੰ ਹੀ ਵਧਾ ਸਕਦੇ ਹਾਂ ਪਰ ਸਰਕਾਰੀ ਨੌਕਰੀ ਦੇ ਵਿੱਚ ਅਸੀਂ ਸਿਰਫ ਇੱਕ ਜਗ੍ਹਾ ਕੰਮ ਕਰਕੇ ਆਇੱਕ ਲਿਮਿਟ ਤੱਕ ਹੀ ਅਸੀਂ ਆਪਣੀ ਕਮਾਈ ਨੂੰ ਕਰ ਸਕਦੇ ਹਾਂ ਅਤੇ ਉਸ ਅ ਅੱਗੇ ਜਾ ਕੇ ਉਹ ਆਪਣੇ ਆਪ ਨੂੰ ਪੈਨਸ਼ਨ ਦੇਣ ਲਈ ਸਹਾਇਤਾ ਦਿੰਦੀ ਹੈ ਪਰ ਆਪਣੇ ਕਾਰੋਬਾਰ 'ਤੇ ਬੰਦਾ ਖੁਦ ਹੀ ਕੰਮ ਕਰਕੇ ਅਤੇ ਆਪਣੀ ਕਮਾਈ ਕਰ ਸਕਦਾ ਹੈ